ਛੋਲੇ ਭਟੂਰੇ ਪੰਜਾਬ ਦੀ ਮਸ਼ਹੂਰ ਡਿਸ਼ ਹੈ ਇਸ ਨੂੰ ਸਵੇਰੇ ਨਾਸ਼ਤੇ ਤਿਉਹਾਰਾਂ ਅਤੇ ਹੋਰ ਸਮਾਗਮਾਂ ਵਿੱਚ ਵੀ ਬਣਾਉਂਦੇ ਹਨ ਅਤੇ ਖਾਏ ਜਾਂਦੇ ਹਨ ਜੇਕਰ ਇਸਨੂੰ ਬਣਾਉਣ ਦੀ ਗੱਲ ਕੀਤੀ ਜਾਵੇ ਤਾਂ ਛੋਲੇ ਭਟੂਰੇ ਛੋਲਿਆਂ ਨੂੰ ਸਭ ਤੋਂ ਪਹਿਲਾਂ ਚਾਰ ਪੰਜ ਘੰਟੇ ਵਾਸਤੇ ਭਿਉਂ ਕੇ ਰੱਖਣਾ ਰੱਖੋ ਭਿਉਂ ਕੇ ਰੱਖੋ ਅਤੇ ਉਸ ਤੋਂ ਬਾਅਦ ਇਸ ਨੂੰ ਤੜਕੇ ਲਈ ਤਿਆਰ ਕਰ ਲਵੋ ਤੜਕੇ ਵਿੱਚ ਪਿਆਜ਼ ਹਰੀ ਮਿਰਚ ਲਾਲ ਟਮਾਟਰ ਗਰਮ ਮਸਾਲੇ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੜਕਾ ਲਗਾ ਕੇ ਵਿੱਚ ਇਸ ਨੂੰ ਪਾ ਦਿੱਤਾ ਜਾਂਦਾ ਹੈ ਪਾਉਣ ਤੋਂ ਬਾਅਦ ਚਾਰ ਪੰਜ ਸੀਟੀਆਂ ਲਗਾਈਆਂ ਜਾਂਦੀਆਂ ਹਨ ਅਤੇ ਆਪਣੇ ਛੋਲੇ ਬਣ ਕੇ ਤਿਆਰ ਹਨ ਭਟੂਰੇ ਬਣਾਉਣ ਦੀ ਸਮੱਗਰੀ ਭਟੂਰੇ ਸਭ ਤੋਂ ਪਹਿਲਾਂ ਮੈਦਾ ਮੈਦੇ ਦੇ ਵਿੱਚ ਦਹੀਂ ਨਮਕ ਓਇਲ ਅਤੇ ਮਿੱਠਾ ਸੋਡਾ ਪਾ ਕੇ ਆਟਾ ਗੁੰਨ ਕੇ ਰੱਖਿਆ ਜਾਂਦਾ ਹੈ ਆਟਾ ਗੁੰਨ ਇਸ ਨੂੰ ਦਸ ਪੰਦਰਾਂ ਮਿੰਟ ਵਾਸਤੇ ਰੈਸਟ ਵਾਸਤੇ ਰੱਖ ਦਿਓ

ਪੰਦਰਾਂ ਵੀਹ ਮਿੰਟ ਬਾਅਦ ਭਟੂਰੇ ਬਣਾਉਣ ਲਈ ਰੱਖ ਲਓ ਅਤੇ ਭਟੂਰੇ ਗਰਮ ਕੜਾਹੀ ਵਿੱਚ ਪਾ ਦਿਓ ਅਤੇ ਆਪਣੇ ਭਟੂਰੇ ਬਣ ਕੇ ਤਿਆਰ ਹਨ ਛੋਲੇ ਭਟੂਰੇ ਥੈਂਕ ਯੂ